ਮੈਂ ਆਪਣੇ ਪਿਛਲੇ ਉੱਤਰ ਵਿੱਚ ਵੀ ਦੱਸਿਆ ਹੈ ਕਿ ਮੈਂ ਖੇਤਰੀ ਭਾਸ਼ਾ ਦਾ ਅਖਬਾਰ ਪੜ੍ਹਨ ਵਿੱਚ ਰੁਚੀ ਰੱਖਦੀ ਹਾਂ ਕਿਉਂਕਿ ਇਸ ਨਾਲ ਆਪਣੇ ਆਲੇ ਦੁਆਲੇ ਦੀ ਖਬਰਸਾਰ ਦਾ ਵੀ ਪਤਾ ਚੱਲਦਾ ਹੈ ਅਤੇ ਸਮਾਂ ਮਿਲਣ 'ਤੇ ਮੈਗਜ਼ੀਨ ਸੈਸ਼ਨ ਵਿੱਚ ਆਉਂਦੇ ਲੇਖਕਾਂ ਦੇ ਕੋਲਮ ਕਹਾਣੀਆਂ ਪੜ੍ਹ ਲੈਂਦੀ ਹਾਂ ਮੈਂ ਆਪਣੇ ਬੱਚਿਆਂ ਦੇ ਰਿਸ਼ਤੇ ਵੀ ਅਖਬਾਰ ਰਾਹੀਂ ਕੀਤੇ ਹਨ